ਅੱਜ ਕੱਲ੍ਹ ਲੋਕ ਵਹਿਮਾਂ ਭਰਮਾਂ 'ਚ ਫਸੇ ਨੇ ਜਿਵੇਂ ਕਿ ਬਿੱਲੀ ਦਾ ਰਸਤਾ ਕੱਟਣਾ ਕੀ ਵੋ ਲੋਕ ਉਹਨਾਂ ਨੂੰ ਵੀ ਵਹਿਮ ਸਮਝਦੇ ਨੇ ਕਿਤੇ ਬਾਹਰ ਜਾਣ ਵੇਲੇ ਕੋਈ ਬਿੱਲੀ ਰਸਤਾ ਕੱਟ ਜਾਵੇ ਉਹਨੂੰ ਵਹਿਮ ਸਮਝ ਲੈ ਕੇ ਕਰ ਕੇ ਕਿ ਮੇਰਾ ਕੰਮ ਨਹੀਂ ਬਣੇਗਾ ਅਤੇ ਇਹ ਮੰਗਲਵਾਰ ਵੀਰਵਾਰ ਨੋਨ ਵੈਜ ਨਹੀਂ ਖਾਣਾ ਕੀ ਸਾਨੂੰ ਉਹ ਕਿਤੇ ਭਾਰੀ ਪੈ ਜਾਵੇਗਾ ਅਤੇ ਸ਼ਨੀਵਾਰ ਕਾਲਾ ਕਾਲੇ ਦਾ ਦਾਨ ਕਰਨਾ ਤੇਲ ਦਾ ਦਾਨ ਕਰਨਾ ਵਹਿਮਾਂ ਭਰਮਾਂ 'ਚ ਲੋਕ ਫਸੇ ਨੇ ਪਏ ਗੈਰ ਵੇ ਬੇਵਜਾਹ ਕੀ ਆਪਾਂ ਵਹਿਮਾਂ ਭਰਮਾਂ 'ਚ ਫਸਣਾ ਸਹੀ ਨਹੀਂ ਹੈ ਜਿਵੇਂ ਵੀਰਵਾਰ ਕੱਪੜੇ ਨਾ ਧੋਣੇ ਅਤੇ ਹੋਰ ਕਈ ਵਹਿਮ ਭਰਮ ਪਰ ਪਏ ਰਹਿੰਦੇ ਨੇ ਜਿਵੇਂ ਕਤੀ ਸੈ ਸੈਚਰਡੇ ਸ਼ਨੀਵਾਰ ਨੂੰ ਅਸੀਂ ਆਪਾਂ ਸਿਰ ਨਹੀਂ ਧੋਣਾ ਕਾਲੇ ਛੋਲੇ ਬਣਾ ਲਓ ਮੰਦਰ ਗੁਰਦੁਆਰੇ ਦੇ ਆਓ ਹੁੰ ਅਤੇ ਕਈ ਜਿਵੇਂ ਚੱਪਲ ਦਾ ਪੁੱਠਾ ਹੋਣਾ ਅਤੇ ਕਈ ਛੋਟੇ ਮੋਟੇ ਵਹਿਮਾਂ ਕਈ ਤਰ੍ਹਾਂ ਤਰ੍ਹਾਂ ਦੇ ਵਹਿਮਾਂ ਵਿੱਚ ਸਾਰਾ ਦੁਨੀਆ ਫਸੀ ਹੋਈ ਹੈ ਇਸਦੇ ਵਹਿਮ ਨਹੀਂ ਕਰਨੇ ਚਾਹੀਦੇ ਜੇ ਬੰਦਾ ਦਾ ਹੋਰ ਮਨੋਬਲ ਵਿਸ਼ਵਾਸ ਹੋਰ ਢਹਿੰਦਾ ਹੈ ਇਸ ਕਰਕੇ ਸਾਨੂੰ ਸਭ ਨੂੰ ਵਹਿਮਾਂ 'ਚ ਨਹੀਂ ਪੈਣਾ ਚਾਹੀਦਾ ਇਸ